ਪਹਿਲਾਂ ਆਪਣੇ ਫੋਨ 'ਤੇ ਮੈਪ ਐਪਲੀਕੇਸ਼ਨ ਨੂੰ ਖੋਲ੍ਹੋ ਜੇਕਰ ਤੁਸੀਂ ਗੂਗਲ ਮੈਪਸ ਦੀ ਵਰਤੋਂ ਕਰ ਰਹੇ ਹੋ ਤਾਂ ਸਰਚ ਬਾਰ 'ਤੇ ਟੈਪ ਕਰੋ ਅਤੇ ਮੇਰੇ ਨੇੜੇ ਕਲੀਨਿਕ ਟਾਈਪ ਕਰੋ ਐਪ ਤੁਹਾਡੇ ਮੌਜੂਦਾ ਸਥਾਨ ਤੋਂ ਉਹਨਾਂ ਦੀਆਂ ਦੂਰੀਆਂ ਦੇ ਨਾਲ ਨੇੜਲੇ ਕਲੀਨਿਕਾਂ ਦੀ ਸੂਚੀ ਪ੍ਰਦਰਸ਼ਿਤ ਕਰੇਗੀ ਉਸ ਨੂੰ ਲੱਭੋ ਜੋ ਸਭ ਤੋਂ ਨੇੜੇ ਹੈ ਜਾਂ ਚੰਗੀਆਂ ਸਮੀਖਿਆਵਾਂ ਹਨ ਇੱਕ ਵਾਰ ਜਦੋਂ ਤੁਸੀਂ ਇੱਕ ਕਲੀਨਿਕ ਚੁਣ ਲੈਂਦੇ ਹੋ ਤਾਂ ਪਤਾ ਅਤੇ ਕੰਮਕਾਜੀ ਸਮੇਂ ਸਮੇਤ ਹੋਰ ਵੇਰਵੇ ਦੇਖਣ ਲਈ ਇਸ 'ਤੇ ਟੈਪ ਕਰੋ ਅੱਗੇ ਦਿਸ਼ਾ ਨਿਰਦੇਸ਼ ਬਟਨ 'ਤੇ ਟੈਪ ਕਰੋ ਐਪ ਕਲੀਨਿਕ ਨੂੰ ਕਦਮ ਦਰ ਕਦਮ ਦਿਸ਼ਾ ਨਿਰਦੇਸ਼ ਪ੍ਰਦਾਨ ਕਰੇਗੀ ਜਿਸ ਦਾ ਤੁਸੀਂ ਪਾਲਣ ਕਰ ਸਕਦੇ ਹੋ ਯਕੀਨੀ ਬਣਾਓ ਕਿ ਤੁਸੀਂ ਦੇਰੀ ਤੋਂ ਬਚਣ ਲਈ ਆਵਾਜਾਈ ਦੀਆਂ ਸਥਿਤੀਆਂ ਅਤੇ ਅਨੁਮਾਨਿਤ ਯਾਤਰਾ ਸਮੇਂ ਦੀ ਜਾਂਚ ਕਰਦੇ ਹੋ ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਤੁਸੀਂ ਵੱਖ ਵੱਖ ਰੂਟਾਂ ਵਿੱਚੋਂ ਚੁਣ ਸਕਦੇ ਹੋ ਜਾਂ ਜੇਕਰ ਤੁਸੀਂ ਪੈਦਲ ਚੱਲ ਰਹੇ ਹੋ ਤਾਂ ਐਪ ਤੁਹਾਨੂੰ ਫੁੱਟਪਾਥਾਂ 'ਤੇ ਮਾਰਗ ਦਰਸ਼ਨ ਕਰੇਗੀ ਜੇ ਜ਼ਰੂਰੀ ਹੋਵੇ ਤਾਂ ਉਹਨਾਂ ਦੀ ਉਪਲਬਧਤਾ ਦੀ ਪੁਸ਼ਟੀ ਕਰਨ ਲਈ ਅੱਗੇ ਕਲੀਨਿਕ ਨਾਲ ਸੰਪਰਕ ਕਰੋ ਅਤੇ ਉਹਨਾਂ ਨੂੰ ਆਪਣੇ ਆਉਣ ਬਾਰੇ ਸੂਚਿਤ ਕਰੋ